ਸਾਡਾ ਧਰਮ ਸਾਨੂੰ ਸਮਾਜ ਸੇਵਾ ਬਾਰੇ ਬਹੁਤ ਸਿਖਾਉਂਦਾ ਹੈ ਸਾਨੂੰ ਸਾਡਾ ਧਰਮ ਦੱਸਦਾ ਹੈ ਕਿ ਤੁਹਾਨੂੰ ਸਾਰਿਆਂ ਨੂੰ ਆਪਣੇ ਗੁਰੂ ਸਾਹਿਬਾਨ ਨਾਲ ਜੋੜਨਾ ਚਾਹੀਦਾ ਹੈ ਜੋ ਵੀ ਕੋਈ ਗਲਤ ਕੰਮ ਕਰੇ ਉਹਨੂੰ ਸਿਖਾਉਣਾ ਚਾਹੀਦਾ ਹੈ ਸੀ ਸਹੀ ਸਿਖਾਉਣਾ ਚਾਹੀਦਾ ਹੈ ਕਿ ਇਹ ਕੰਮ ਗਲਤ ਹੈ ਇਸ ਸਾਡੀ ਗੁਰਬਾਣੀ ਦੱਸਦੀ ਹੈ ਕਿ ਸਮਾਜ ਵਿੱਚ ਕੀ ਕੀ ਗਲਤ ਹੈ ਕੀ ਗਲਤ ਹੈ ਕੀ ਸਹੀ ਹੈ ਸਾਨੂੰ ਹਮੇਸ਼ਾਂ ਸੱਚ ਦਾ ਸਾਥ ਦੇਣਾ ਚਾਹੀਦਾ ਹੈ ਸੱਚ ਦੇ ਚਲਦਿਆਂ ਸਾਰੇ ਦੁਨੀਆਂ ਸਾਰੀ ਤੁਹਾਨੂੰ ਇੱਜ਼ਤ ਮਾਨ ਬਕਸ਼ਦੀ ਹੈ ਜਦੋਂ ਤੁਸੀਂ ਝੂਠ ਬੋਲੋਗੇ ਇੱਕ ਝੂਠ ਬੋਲੋ ਦੋ ਝੂਠ ਬੋਲੋ ਝੂਠ ਦੀ ਦੁਨੀਆਂ ਨਹੀਂ ਕਾਇਮ ਸੱਚ 'ਤੇ ਦੁਨੀਆਂ ਕਾਇਮ ਹੈ ਇਸ ਕਰਕੇ ਹਮੇਸ਼ਾਂ ਸਾਨੂੰ ਸੱਚ ਦਾ ਸਾਥ ਦੇਣਾ ਚਾਹੀਦਾ ਹੈ ਸੱਚੀ ਦਰਗਾਹ ਪਾ ਕਹਿੰਦੇ ਦਰ ਸੱਚੀ ਦਰ ਸੱਚੀ ਦਰ ਸੱਚੇ ਸੱਚੀ ਬੰਦੇ ਨੂੰ ਸੱਚੇ ਬੰਦੇ ਨੂੰ ਦਰਗਾਹ ਵਿੱਚ ਵੀ ਜਗ੍ਹਾ ਮਿਲਦੀ ਹੈ ਇਸ ਕਰਕੇ ਸਾਡਾ ਧਰਮ ਇਹ ਸਿਖਾਉਂਦਾ ਸਾਡੇ ਗੁਰੂ ਸਾਹਿਬਾਨ ਨੇ ਲਿਖਿਆ ਹੈ ਜਪਜੀ ਸਾਹਿਬ ਵਿੱਚ ਹੀ ਦੱਸਿਆ ਹੈ ਕਿ ਸਾਨੂੰ ਸਾਰੇ ਸਮਾਜ ਵਿੱਚ ਸਮਾਜ ਦੇ ਹਰ ਇੱਕ ਬੰਦੇ ਦੀ ਸੇਵਾ ਕਰਨੀ ਚਾਹੀਦੀ ਹੈ ਚਾਹੇ ਉਹ ਛੋਟਾ ਹੈ ਵੱਡਾ ਹੈ ਗਰੀਬ ਹੈ ਅਮੀਰ ਹੈ ਕੁਛ ਵੀ ਹੈ ਸਾਡੇ ਵੱਡਿਆਂ ਦੀ ਸਾਡੇ ਮਾਂ ਬਾਪ ਦੀ ਜਿਹਨਾਂ ਨੇ ਸਾਨੂੰ ਜਨਮ ਦਿੱਤਾ ਹੈ ਉਹਦੀ ਸੇਵਾ ਪਹਿਲੇ ਕਹਿੰਦੇ ਪਾਠ ਕੀਤਾ ਇੱਕ ਪਾਸੇ ਹੈ ਮਾਂ ਪਿਓ ਦੀ ਸੇਵਾ ਇੱਕ ਪਾਸੇ ਇਸ ਕਰਕੇ ਸਾਨੂੰ ਸਾਡਾ ਮਾਂ ਪਿਓ ਵਿੱਚ ਸਾਡਾ ਰੱਬ ਵਸਦਾ ਇਸ ਕਰਕੇ ਸਭ ਤੋਂ ਅੱਛੀ ਸੇਵਾ ਮਾਂ ਬਾਪ ਦੀ ਮੰਨੀ ਜਾਂਦੀ ਹੈ ਜਿਸਨੇ ਮਾਂ ਬਾਪ ਦੀ ਸੇਵਾ ਨਹੀਂ ਕੀਤੀ ਉਸਦਾ ਸਾਰਾ ਕੀਤਾ ਧਰਮ ਅਰਥ ਨਹੀਂ ਉਹ ਵਿਅਰਥ ਹੈ ਇਸ ਕਰਕੇ ਤੁਸੀਂ ਇੱਕ ਪਾਸੇ ਪਾਠ ਪੂਜਾ ਨਾ ਕਰੋ ਰੱਬ ਦੀ ਸੇਵਾ ਮਾਂ ਪਿਓ ਦੀ ਸੇਵਾ ਕਰੋ ਉਹਦੇ ਨਾਲ ਤੁਹਾਨੂੰ ਅਨੇਕਾਂ ਫਲ ਪ੍ਰਾਪਤ ਹੁੰਦੇ ਹਨ ਜਿਸ ਨੇ ਮਾਂ ਪਿਓ ਦੀ ਸੇਵਾ ਕੀਤੀ ਉਸਨੂੰ ਸਾਰਾ ਜਹਾਨ ਮਲਕਿ ਜੰਨਤ ਕਹਿੰਦੇ ਮਾਂ ਪਿਓ ਦੇ ਪੈਰਾਂ 'ਚ ਹੁੰਦੀ ਇਸ ਕਰਕੇ ਚਾਹੇ ਮਾਂ ਪਿਓ ਗਲਤ ਹੈ ਸਹੀ ਹੈ ਚੰਗਾ ਹੈ ਮਾੜਾ ਕਿੱਤੇ ਦਾ ਉਸਨੇ ਸਾਨੂੰ ਜਨਮ ਦਿੱਤਾ ਉਸ ਦਾ ਜਨਮ ਦਿੱਤਾ ਹੋਇਆ ਹੈ ਉਸ ਦੀ ਵੀ ਅਸੀਂ ਉਸਦੀ ਉਹਨੇ ਸਾਨੂੰ ਜਨਮ ਦੇ ਕੇ ਦੁਨੀਆਂ ਦਿਖਾਈ ਹੈ ਉਹਦਾ ਦੇਣਾ ਅਸੀਂ ਨਹੀਂ ਦੇ ਸਕਦੇ ਇਸ ਕਰਕੇ ਸਾਨੂੰ ਮਾਂ ਪਿਓ ਦੀ ਸੇਵਾ ਕਰਨੀ ਚਾਹੀਦੀ ਹੈ ਮਾਂ ਪਿਓ ਦੀ ਸੇਵਾ ਸਭ ਤੋਂ ਉੱਚੀ ਸੇਵਾ ਮੰਨੀ ਜਾਂਦੀ ਹੈ ਸਮਾਜ ਦੀ ਸੇਵਾ ਸਮਾਜ ਵਿੱਚ ਰਹਿਣ ਵਾਲੇ ਬੰਦੇ ਦੁਨੀਆਂ ਦੇ ਵਿੱਚ ਰਹਿਣ ਵਾਲੇ ਸਮਾਜ ਇਸ ਕਰਕੇ ਸਾਨੂੰ ਹਰ ਇੱਕ ਸਮਾਜ ਹਰ ਇਕ ਬੰਦੇ ਦਾ ਜੋ ਵੀ ਸੱਚਾ ਸੱਚਾਈ ਦੇ ਨਾਲ ਸਾਥ ਦੇਣਾ ਚਾਹੀਦਾ ਹੈ ਸਮਾਜ ਸੇਵਾ ਹੋਰ ਸਮਾਜਿਕ ਸੇਵਾਵਾਂ ਵੀ ਹੋਰ ਵੀ ਸਾਨੂੰ ਪੈਸੇ ਦੇ ਨਾਲ ਕਿਸੇ ਦਾ ਮਤਲਬ ਸਾਨੂੰ ਮਦਦ ਹਰ ਤਰ੍ਹਾਂ ਦੀ ਮਦਦ ਕਰਨੀ ਚਾਹੀਦੀ ਚਾਹੇ ਉਹ ਪੈਸੇ ਦੀ ਸੇਵਾ ਹੈ ਚਾਹੇ ਉਹ ਖਾਣ ਪੀਣ ਦੀ ਸੇਵਾ ਕੁਛ ਵੀ ਕਿਸੇ ਤਰ੍ਹਾਂ ਦੀ ਸੇਵਾਵਾਂ ਹੈ ਸੇਵਾ ਕਦੇ ਵਿਅਰਥ ਨਹੀਂ ਜਾਂਦੀ ਕਦੀ ਨਾ ਕਦੇ ਉਸ ਸੇਵਾ ਦਾ ਫਲ ਪ੍ਰਾਪਤ ਹੁੰਦਾ ਚਾਹੇ ਅੱਜ ਚਾਹੇ ਕੱਲ੍ਹ ਚਾਹੇ ਜਦੋਂ ਮਰਜ਼ੀ ਇਹ ਫਲ ਮਿਲਦਾ ਹੀ ਮਿਲਦਾ ਹੈ ਪਰਮਾਤਮਾ ਜੇ ਸੇਵਾ ਜੇ ਜੋ ਬੰਦਾ ਸੇਵਾ ਕਰਦਾ ਹੈ ਉਸ ਉਸਨੂੰ ਫਲ ਪਰਮਾਤਮਾ ਦਿੰਦਾ ਹੀ ਦਿੰਦਾ ਹੈ ਚਾਹੇ ਜਿੱਦਾਂ ਦੀ ਮਰਜ਼ੀ ਸੇਵਾ ਸਮਾਜਿਕ ਸੇਵਾ ਪੈਸੇ ਦੀ ਸੇਵਾ ਧਰਮ ਦੀ ਸੇਵਾ ਸੇਵਾਵਾਂ ਬਹੁਤ ਹਨ ਦੁਨੀਆਂ ਦੇ ਵਿੱਚ ਪਰ ਕਰਨ ਵਾਲੇ ਬਹੁਤ ਘੱਟ ਨੇ ਇਸ ਕਰਕੇ ਜਿੰਨਾ ਹੋ ਸਕੇ ਜੋ ਹੋ ਸਕੇ ਪਰਮਾਤਮਾ ਇਹੀ ਕਹਿੰਦਾ ਕਿ ਹਰ ਇੱਕ ਦਾ ਮਾਣ ਰੱਖੋ ਹਰ ਇੱਕ ਦਾ ਸਾਥ ਦਿਓ ਹਰ ਇੱਕ ਦੇ ਦੁੱਖ ਸੁੱਖ ਵਿੱਚ ਉਸਦਾ ਸਾਥ ਦਿਓ ਇਹ ਇੱਕ ਸਮਾਜ ਸੇਵਾ ਹੈ ਇਸ ਕਰਕੇ ਸਾਨੂੰ ਹਮੇਸ਼ਾਂ ਸੇਵਾ ਵੱਲ ਹੀ ਸਾਨੂੰ ਪਰਮਾਤਮਾ ਸਾਡਾ ਪ੍ਰੇਰਿਤ ਕਰਦਾ ਹੈ ਜੋ ਜਿੱਦਾਂ ਵੀ ਹੋ ਸਕੇ ਜਿਸ ਤਰ੍ਹਾਂ ਵੀ ਹੋ ਸਕੇ ਬਹੁਤ ਧਰਮ ਇਸੇ ਵਾਸਤੇ ਤਾਂ ਹੈ ਸਾਨੂੰ ਨਿਤਨੇਮ ਦੇ ਨਾਲ ਜੁੜਨਾ ਚਾਹੀਦਾ ਹੈ ਬਾਣੀ ਨਾਲ ਜੁੜਨਾ ਚਾਹੀਦਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਹਮੇਸ਼ਾਂ ਸਮਾਜਿਕ ਸੇਵਾਵਾਂ ਜਿਸ ਤਰ੍ਹਾਂ ਕਿ ਅਨਾਥ ਆਸ਼ਰਮ ਖੋਲ੍ਹਦੇ ਹਨ ਉਹਨਾਂ ਵਿੱਚ ਗਰੀਬਾਂ ਦੀ ਅਨਾਥਾਂ ਦੀ ਸੇਵਾ ਕੀਤੀ ਜਾਂਦੀ ਹੈ ਇਹ ਵੀ ਸੇਵਾ ਬਹੁਤ ਵੱਡੀ ਸੇਵਾ ਮੰਨੀ ਜਾਂਦੀ ਹੈ ਸਾਡੇ ਸਮਾਜ ਵਿੱਚ ਸਾਡੇ ਪੰਜਾਬ ਵਿੱਚ ਬਹੁਤ ਹੀ ਸੰਸਥਾਵਾਂ ਖੁੱਲ੍ਹੀਆਂ ਹਨ ਔਰਤਾਂ ਲਈ ਵੀ ਬੜੇ ਹੀ ਸਥਾਨ ਖੁੱਲ੍ਹੇ ਹੋਏ ਹਨ ਜਿਹਨਾਂ ਦਾ ਕੋਈ ਨਹੀਂ ਹੁੰਦਾ ਜਿਹਨਾਂ ਦੇ ਬੱਚੇ ਮਾਂ ਪਿਓ ਨੂੰ ਘਰੋਂ ਕੱਢ ਦਿੰਦੇ ਹਨ ਉਹਨਾਂ ਲਈ ਉਹਨਾਂ ਦੀ ਸੇਵਾ ਉਹਨਾਂ ਦੀ ਸੇਵਾ ਵਾਸਤੇ ਬਿਰਧ ਆਸ਼ਰਮ ਖੋਲ੍ਹੇ ਗਏ ਹਨ ਉਹਦੇ ਵਿੱਚ ਸੇਵਾ ਕਰਨ ਵਾਲਿਆਂ ਦੀ ਸੇਵਾ ਬਹੁਤ ਵੱਡੀ ਇਸ ਕਰਕੇ ਸਾਨੂੰ ਇਹਨਾਂ ਸਮਾਜਿਕ ਸੇਵਾਵਾਂ ਵਿੱਚ ਹਿੱਸਾ ਲੈਣ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਇਹ ਸੇਵਾ ਵਿਅਰਥ ਨਹੀਂ ਜਾਂਦੀ ਬਹੁਤ ਰੰਗ ਲਾਉਂਦੀ ਹੈ ਕਦੇ ਨਾ ਕਦੇ ਅੱਜ ਕੱਲ੍ਹ ਜਦੋਂ ਜ਼ਿੰਦਗੀ ਵਿੱਚ ਇਸਦਾ ਫਲ ਪ੍ਰਾਪਤ ਹੁੰਦਾ ਹੈ ਧੰਨਵਾਦ